ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਬਾਈ ਅਕਤੂਬਰ ਦੋ ਹਜ਼ਾਰ ਦੋ ਪੱਚੀ ਅਕਤੂਬਰ ਉੱਨੀ ਸੌ ਅੱਸੀ ਪੰਜ ਅਕਤੂਬਰ ਦੋ ਹਜ਼ਾਰ ਛੇ